ਸਤਿ ਸ਼੍ਰੀ ਅਕਾਲ ਜੀ ਅਸੀਂ ਅੱਧਾ ਘੰਟਾ ਪਹਿਲਾਂ ਇੱਕ ਕੈਬ ਬੁੱਕ ਕੀਤੀ ਸੀ ਪਰ ਜੋ ਕੈਬ ਡਰਾਈਵਰ ਹੈ ਉਹ ਸਾ ਨਾ ਤਾਂ ਸਾਡਾ ਫੋਨ ਚੱਕ ਰਿਹਾ ਏ ਅਤੇ ਨਾ ਸਾਨੂੰ ਕੋਈ ਰਿਪਲਾਈ ਦੇ ਰਿਹਾ ਏ ਅਤੇ ਸਾਨੂੰ ਬਹੁਤ ਅਰਜੈਂਟ ਕੰਮ 'ਤੇ ਜਾਣਾ ਸੀਗਾ ਜਿਸ ਕਰਕੇ ਸਾਡੀ ਅੱਜ ਕੈਬ ਹੈ ਇਹ ਰੱਦ ਕੀਤੀ ਜਾਵੇ ਤਾਂ ਜੋ ਅਸੀਂ ਇੱਕ ਹੋਰ ਨਵੀਂ ਕੈਬ ਕਰ ਸਕੇ ਸਕੀਏ ਤਾਂ ਜੋ ਸਾਡਾ ਕੰਮ ਸਹੀ ਟਾਈਮ 'ਤੇ ਹੋ ਸਕੇ ਧੰਨਵਾਦ